ਸਾਡੇ ਰਾਜ ਵਿੱਚ ਬਹੁਤ ਧਾਰਮਿਕ ਅਸਥਾਨ ਹਨ ਮੁਸਲਮਾਨ ਵੀਰਾਂ ਲਈ ਇੱਥੇ ਮੱਕਾ ਬ ਰੋਜ਼ਾ ਸ਼ਰੀਫ ਬਣਿਆ ਹੋਇਆ ਹੈ ਇਹ ਰੋਜ਼ਾ ਸ਼ਰੀਫ ਨੂੰ ਆਪਣਾ ਦੂਸਰਾ ਮੱਕਾ ਮੰਨਦੇ ਹਨ ਇੱਥੇ ਹਰ ਸਾਲ ਇਹਨਾਂ ਵਾਸਤੇ ਬਹੁਤ ਵੱਡਾ ਮੇਲਾ ਭਰਦਾ ਹੈ ਜੋ ਕਿ ਬਹੁਤ ਦੂਰ ਦੂਰ ਤੋਂ ਮੁਸਲਮਾਨ ਵੀਰ ਆਣ ਕੇ ਇੱਥੇ ਸਿਜਦਾ ਕਰਦੇ ਹਨ ਮੱਥਾ ਟੇਕਦੇ ਹਨ ਅਤੇ ਆਪਣੀਆਂ ਮੰਨਤਾਂ ਪੂਰੀਆਂ ਕਰਦੇ ਹਨ ਉਸ ਤੋਂ ਬਾਅਦ ਇੱਥੇ ਹਿੰਦੂ ਵੀਰਾਂ ਲਈ ਨਲਾਸ ਦੇ ਵਿੱਚ ਸ਼ਿਵ ਜੀ ਭੋਲੇ ਸ਼ੰਕਰ ਜੀ ਦਾ ਬਹੁਤ ਵੱਡਾ ਮੰਦਰ ਬਣਿਆ ਹੋਇਆ ਹੈ ਇੱਥੇ ਹਰ ਸਾਲ ਸ਼ਿਵਰਾਤਰੀ ਭਰਦੀ ਹੈ ਅਤੇ ਬਹੁਤ ਦੂਰ ਦੂਰ ਤੋਂ ਲੋਕ ਚੱਲ ਕੇ ਇੱਥੇ ਨਲਾਸ ਵਿੱਚ ਆਉਂਦੇ ਹਨ ਮੰਦਰ 'ਚ ਮੱਥਾ ਟੇਕਣ ਵਾਸਤੇ ਆ ਪੂਜਾ ਕਰਦੇ ਹਨ ਅਤੇ ਆਪਣੀਆਂ ਮੰਨਤਾਂ ਮੰਗਦੇ ਹਨ ਉਹਨਾਂ ਦੀਆਂ ਮੰਨਤਾਂ ਪੂਰੀਆਂ ਵੀ ਹੁੰਦੀਆਂ ਹਨ ਅਤੇ ਇੱਥੇ ਜੈਨ ਮੰਦਰ ਵੀ ਹੈ ਜੈਨ ਮੀਰਾ ਵੀਰਾਂ ਵਾਸਤੇ ਉਸ ਤੋਂ ਬਾਅਦ ਸਿੱਖਾਂ ਵਾਸਤੇ ਚਮਕੌਰ ਸਾਹਿਬ ਜਿੱਥੇ ਵੱਡੇ ਸਾਹਿਬਜ਼ਾਦਿਆਂ ਨੂੰ ਸਾਹਿਬਜ਼ਾਦੇ ਜ਼ਾਲਮਾਂ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਸਨ ਉਸ ਤੋਂ ਬਾਅਦ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਜੀ ਜਿੱਥੇ ਧੰਨ ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਮਾਤਾ ਮਾਤਾ ਗੁਜਰ ਕੌਰ ਜੀ ਉਹਨਾਂ ਨੂੰ ਵੀ ਸ਼ਹੀਦ ਕੀਤਾ ਗਿਆ ਸੀ ਠੰਡੇ ਬੁਰਜ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੂੰ ਕੈਦ ਕਰਕੇ ਰੱਖਿਆ ਉਸ ਤੋਂ ਬਾਅਦ ਨੀਹਾਂ ਵਿੱਚ ਚਿਣ ਕੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਅਤੇ ਇੱਥੇ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਜੀ ਹੈ ਜਿੱਥੇ ਛੋਟੇ ਸਾਹਿਬਜ਼ਾਦਿਆਂ ਦਾ ਅਤੇ ਮਾਤਾ ਗੁਜਰ ਕੌਰ ਜੀ ਦਾ ਸਸਕਾਰ ਕੀਤਾ ਗਿਆ ਸੀ ਇੱਥੇ ਦੀਵਾਨ ਟੋਡਰਮੱਲ ਜੀ ਨੇ ਮੋਹਰਾਂ ਖੜ੍ਹੀਆਂ ਕਰਕੇ ਜਗ੍ਹਾ ਖਰੀਦੀ ਸੀ ਜਿੱਥੇ ਮਾਤਾ ਗੁਜਰ ਕੌਰ ਜੀ ਦਾ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸਸਕਾਰ ਕੀਤਾ ਸੀ ਇਹ ਦੁਨੀਆਂ ਦੀ ਸਭ ਤੋਂ ਮਹਿੰਗੀ ਜਗ੍ਹਾ ਹੈ ਇੱਥੇ ਅਸੀਂ ਹਰ ਰੋਜ਼ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਜੀ ਵਿਖੇ ਜਾਂਦੇ ਹਾਂ ਅਤੇ ਬਾਣੀ ਪੜ੍ਹਦੇ ਹਾਂ ਆਨੰਦ ਲੈਂਦੇ ਹਾਂ ਇੱਥੇ ਬਹੁਤ ਹੀ ਜ਼ਿਆਦਾ ਪਵਿੱਤਰ ਅਸਥਾਨ ਹੈ ਇੱਥੇ ਸੇਵਾ ਕਰਕੇ ਅਤੇ ਜੋੜੇ ਘਰ ਦੀ ਸੇਵਾ ਕਰਕੇ ਆਪਾਂ ਜੂਠੇ ਬਰਤਨਾਂ ਦੀ ਸੇਵਾ ਕਰਕੇ ਅਸੀਂ ਆਪਣਾ ਜੀਵਨ ਸਫਲਾ ਕਰਦੇ ਹਾਂ ਹਰ ਰੋਜ਼ ਅੰਮ੍ਰਿਤ ਵੇਲੇ ਇੱਥੇ ਆਸਾਂ ਜੀ ਦੀ ਵਾਰ ਦਾ ਪਾਠ ਹੁੰਦਾ ਹੈ ਗੁਰਬਾਣੀ ਹਰ ਰੋਜ਼ ਗੁਰਬਾਣੀ ਸਵੇਰੇ ਅੰਮ੍ਰਿਤ ਵੇਲੇ ਤੋਂ ਲੈ ਕੇ ਸ਼ਾਮ ਰਾਤ ਨੂੰ ਰਾਤ ਤੱਕ ਗੁਰਬਾਣੀ ਜੋ ਕਿ ਚੱਲਦੀ ਹੈ ਇਹ ਬਹੁਤ ਹੀ ਵਧੀਆ ਸਥਾਨ ਹੈ ਇੱਥੇ ਹਰ ਸਾਲ ਅਠਾਈ ਦਸੰਬਰ ਨੂੰ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ ਜਿੱਥੇ ਲੋਕ ਦੇਸ਼ਾਂ ਵਿਦੇਸ਼ਾਂ ਤੋਂ ਚੱਲ ਕੇ ਇੱਥੇ ਆਉਂਦੇ ਹਨ ਨਗਰ ਕੀਰਤਨ ਵਿੱਚ ਇਹ ਧੰਨ ਧੰਨ ਮਾਤਾ ਗੁਜਰ ਕੌਰ ਜੀ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਧੰਨ ਧੰਨ ਬਾਬਾ ਫਤਿਹ ਸਿੰਘ ਧੰਨ ਧੰਨ ਮਾਤਾ ਗੁਜਰ ਕੌਰ ਜੀ ਦੀ ਅਦੁੱਤੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਨਗਰ ਕੀਰਤਨ ਸਜਾਇਆ ਜਾਂਦਾ ਹੈ ਇਸ ਦਿਨ ਇਹਨਾਂ ਨੂੰ ਇਹਨਾਂ ਦੀ ਸ਼ਹੀਦੀ ਹੋਈ ਸੀ ਇਸ ਕਰਕੇ ਨਗਰ ਕੀਰਤਨ ਸਜਾਇਆ ਜਾਂਦਾ ਹੈ ਇਹ ਬਹੁਤ ਹੀ ਪਵਿੱਤਰ ਸਥਾਨ ਹੈ ਸਿੱਖਾਂ ਵਾਸਤੇ ਬਹੁਤ ਦੂਰ ਦੂਰ ਤੋਂ ਲੋਕ ਇਥੇ ਆਣ ਕੇ ਦਰਸ਼ਨ ਦੀਦਾਰੇ ਕਰਦੇ ਹਨ ਅਤੇ ਆਪਣੀਆਂ ਮਨੋਕਾਮਨਾ ਪੂਰੀਆਂ ਕਰਦੇ ਹਨ